ਹੈਲੋ ਜੀ ਗੁਡ ਆਫਟਰਨੂਨ ਜੀ ਹਾਂਜੀ ਹਾਂ ਅੱਛਾ ਜੀ

ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਦੱਸੋ ਜੀ ਅੱਛਾ ਜੀ ਕਿਵੇਂ ਪੜ੍ਹਦਾ ਜੀ ਇਹ ਜੀ ਘਰ ਪੜ੍ਹਦਾ ਤਾਂ ਹੁੰਦਾ ਜੀ ਇਹ ਮਤਲਬ ਅੰਦਰ ਚਲੇ ਜਾਂਦਾ ਜੀ ਮਤਲਬ ਪਤਾ ਹੀ ਨਹੀਂ ਲੱਗਦਾ ਪੜ੍ਹਦਾ ਏ ਕਿ ਨਹੀਂ ਜੀ ਹਾਂਜੀ ਟਿਊਸ਼ਨ ਨਾ ਜੀ ਹੁਣ ਰਖਾਏਗੇ ਜ਼ਰੂਰੀ ਜੀ ਹੁਣ ਕਹਿੰਦੇ ਤੁਸੀਂ ਪੜ੍ਹਦਾ ਨਹੀਂ ਅੱਛਾ ਜੀ ਉਵੇਂ ਰਖਾ ਦੂੰਗੇ ਜੀ ਅੱਛਾ ਜੀ ਦੱਸ ਦਿਉ ਜੀ ਕਿਹੜੇ ਸਬਜੈਕਟ 'ਚ ਕਿੰਨੇ ਨੰਬਰ ਨੇ ਜੀ ਅੱਛਾ ਜੀ ਹਿੰਦੀ 'ਚ ਜਮਾਂ ਹੀ ਲੋਅ ਆ ਜੀ ਹਿੰਦੀ ਇਹਨੂੰ ਘੱਟ ਆਉਂਦੀ ਮਾੜੀ ਜੀ

ਅੱਛਾ ਜੀ ਅੱਛਾ ਜੀ ਵੇਖ ਲਿਓ ਜੀ ਤੁਸੀਂ ਜੀ ਘਰ ਤਾਂ ਵਾ ਠੀਕ ਠਾਕ ਏ ਪੜ੍ਹਦਾ ਜੀ ਮਤਲਬ ਇੰਨਾਂ ਪੜ੍ਹਦਾ ਨਹੀਂ ਹੈਗਾ ਜੀ ਕਦੇ ਖੇਡਣ ਖੁਡਣ ਲੰਘ ਜਾਂਦਾ ਜੀ ਲੇਟ ਆਉਂਦਾ ਫਿਰ ਘਰ ਜੀ ਕੋਈ ਨਾ ਜੀ ਹੁਣ ਅਸੀਂ ਦਿੰਦੇ ਹਾਂ ਧਿਆਨ ਇਹਦੇ ਵੱਲ ਮਾੜਾ ਜਿਹਾ ਜੀ ਅੱਛਾ ਚਲੋ ਸਰ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਓਕੇ